ਹੈਲੋ ਤੁਸੀਂ ਕਿਰਨਜੀਤ ਕੌਰ ਬੋਲਦੇ ਹੋ ਹਾਂਜੀ ਮੈਡਮ ਅਸੀਂ ਨਾ ਰਾਜਸਥਾਨ ਤੋਂ ਘੁੰਮਣ ਆਉਣਾ ਤਾਂ ਤੁਹਾਡੇ ਇਲਾਕੇ ਵਿੱਚ ਕੁਝ ਜਗ੍ਹਾ ਹੈਗੀਆਂ ਮਹਾਰਾਜਾ ਰਣਜੀਤ ਸਿੰਘ ਦੀਆਂ ਉਹਨਾਂ ਬਾਰੇ ਸਾਨੂੰ ਕੁਝ ਜਾਣਕਾਰੀ ਦੇ ਸਕਦੇ ਹੋ

ਹਮ ਹਾਂਜੀ ਹਾਂਜੀ ਹਾਂਜੀ ਮੈਡਮ ਹਾਂਜੀ ਮੈਡਮ ਹਾਂਜੀ ਮੈਡਮ ਜੀ ਮੈਡਮ ਹਾਂਜੀ ਮੈਡਮ ਓਕੇ ਓਕੇ ਓਕੇ ਥੈਂਕ ਯੂ ਮੈਮ